ਹੈਲੋ ਹਾਂਜੀ ਕੌਣ ਬੋਲ ਰਿਹਾ ਜੀ ਹਾਂਜੀ ਗੁਡ ਮੋਰਨਿੰਗ ਹਾਂਜੀ ਹਾਂਜੀ ਮੈਮ ਬਿਲਕੁਲ ਹਾਂਜੀ ਅੱਛਾ ਜੀ ਅੱਛਾ ਜੀ ਹਾਂਜੀ ਪੱਚੀ ਸਾਲਾਂ ਦਾ ਐਕਸਪੀਰੀਅੰਸ ਹੈ ਪੱਚੀ ਸਾਲਾਂ ਦਾ ਐਕਸਪੀਰੀਅੰਸ ਅੱਛਾ ਜੀ ਵੈਰੀ ਗੁੱਡ ਅੱਛਾ ਜੀ ਠੀਕ ਹੈ ਜੀ ਠੀਕ ਹੈ ਮੈਮ ਅੱਛਾ ਜੀ ਹਾਂਜੀ ਤੁਸੀਂ ਬਿਲਕੁਲ ਸਹੀ ਸੁਣਿਆ ਹਾਂਜੀ ਸਾਨੂੰ ਐਕਸਪੀਰੀਅੰਸ ਟੀਚਰ ਚਾਹੀਦੇ ਨੇ ਅਤੇ ਪ੍ਰੋਬਲਮ ਇਹ ਸੀ ਕਿ ਸਾਡੇ ਪੰਜਾਬੀ ਮੈਡਮ ਹੁਣੀ ਹੁਣੀ ਥੋੜ੍ਹੀ ਉਹਨਾਂ ਨੂੰ ਹੈਲਥ ਇਸ਼ੂ ਦੇ ਕਰਕੇ ਉਹ ਛੱਡ ਕੇ ਗਏ ਨੇ ਤਾਂ ਇਸ ਕਰਕੇ ਸਾਨੂੰ ਪੰਜਾਬੀ ਟੀਚਰ ਦੀ ਰਿਕੁਇਰਮੈਂਟ ਸੀਗੀ ਅਤੇ ਸਾਡੇ ਲਈ ਬਹੁਤ ਖੁਸ਼ੀ ਵਾਲੀ ਗੱਲ ਹੋਏਗੀ ਅਗਰ ਸਾਨੂੰ ਐਕਸਪੀਰੀਅੰਸ ਟੀਚਰ ਮਿਲੇਗਾ ਹਾਂਜੀ ਹਾਂਜੀ ਹਾਂਜੀ ਹਾਂਜੀ ਅਸੀਂ ਦਿੱਤੀ ਸੀ ਅੱਛਾ ਜੀ ਅੱਛਾ ਜੀ ਹਾਂਜੀ ਮੈਮ ਤੁਸੀਂ ਮੰਡੇ ਮੋਰਨਿੰਗ 'ਚ ਨੌਂ ਵਜੇ ਨੌਂ ਤੋਂ ਦਸ ਵਜੇ ਤੱਕ ਮੈਨੂੰ ਆ ਕੇ ਮਿਲ ਸਕਦੇ ਹੋ ਹਾਂ ਮੈਨੂੰ ਬੜੀ ਖੁਸ਼ੀ ਹੋਏਗੀ ਕਿ ਤੁਸੀਂ ਬਹੁਤ ਵਧੀਆ ਐਕਸਪੀਰੀਅੰਸ ਲੈ ਕੇ ਆ ਰਹੇ ਹੋ ਅਤੇ ਤੁਸੀਂ ਜਿਵੇਂ ਉੱਥੇ ਤੁਸੀਂ ਵੀਹ ਸਾਲ ਲਗਾਏ ਨੇ ਪੰਜ ਸਾਲ ਲਗਾਏ ਨੇ ਕਿ ਇੱਕ ਤੁਸੀਂ ਸਾਡੇ ਸਕੂਲ ਦੇ ਵਿੱਚ ਵੀ ਵਧੀਆ ਟਾਈਮ ਲਗਾਓਗੇ ਠੀਕ ਹੈ ਅਤੇ ਮੈਨੂੰ ਬੜੀ ਖੁਸ਼ੀ ਹੋਏਗੀ ਤੁਸੀਂ ਨੌਂ ਵਜੇ ਤੋਂ ਦਸ ਵਜੇ ਤੱਕ ਮੈਨੂੰ ਆ ਕੇ ਸਕੂਲ ਦੇ ਦਫਤਰ ਦੇ ਵਿੱਚ ਮਿਲ ਸਕਦੇ ਹੋ ਵੈਲਕਮ ਓਕੇ ਓਕੇ